ਛੱਬੀ ਅਗਸਤ ਦੋ ਹਜ਼ਾਰ ਇੱਕ ਨੌ ਜੁਲਾਈ ਦੋ ਹਜ਼ਾਰ ਨੌ ਅ ਅੱਠ ਸਤੰਬਰ ਦੋ ਹਜ਼ਾਰ ਗਿਆਰ੍ਹਾਂ ਨੌ ਜਨਵਰੀ ਦੋ ਹਜ਼ਾਰ ਚੌਦ੍ਹਾਂ ਔਰ ਛੱਬੀ ਦਸੰਬਰ ਦੋ ਹਜ਼ਾਰ ਅਠਾਰ੍ਹਾਂ